ਸਤਿ ਸ਼੍ਰੀ ਅਕਾਲ ਸਰ ਸਰ ਮੈਂ ਤੁਹਾਨੂੰ ਇੱਕ ਅਰਜੈਂਟਲੀ ਰਿਪੋਰਟ ਦੇਣਾ ਚਾਹੁੰਦਾ ਹਾਂ ਇਸ ਰਿਪੋਰਟ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੈਂ ਇੱਕ ਕੈਬ ਬੁੱਕ ਕੀਤੀ ਸੀ ਜਿਸ ਵਿੱਚ ਮੈਂ ਅਤੇ ਮੇਰੇ ਪੂਰੇ ਪਰਿਵਾਰ ਨੇ ਜਲੰਧਰ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਤੈਅ ਕਰਨਾ ਸੀ ਅਤੇ ਤੁਹਾਡੀ ਕੰਪਨੀ ਤੋਂ ਇੱਕ ਕੈਬ ਬੁੱਕ ਕੀਤੀ ਸੀ ਇਸ ਕੈਬ ਨੂੰ ਮੈਂ ਪੂਰੇ ਗਿਆਰਾਂ ਵਜੇ ਆਉਣ ਦਾ ਟਾਈਮ ਦਿੱਤਾ ਸੀ ਅਤੇ ਸਥਾਨ ਪੂਰਾ ਦੱਸਿਆ ਸੀ ਵੀ ਕਿੱਥੇ ਆਉਣਾ ਪਰ ਤੁਹਾਡਾ ਕੈਬ ਵਾਲਾ ਬੰਦਾ ਟਾਈਮ 'ਤੇ ਨਹੀ ਪਹੁੰਚਿਆ ਅਤੇ ਨਾ ਹੀ ਕੋਈ ਤੁਹਾਡੀ ਕੰਪਨੀ ਵੱਲੋਂ ਫੋਨ ਆਇਆ ਗਿਆ ਕਿ ਕੈਬ ਆ ਰਹੀ ਹੈ ਜਾ ਨਹੀਂ ਆ ਰਹੀ ਜਿਸ ਕਰਕੇ ਸਾਡੇ ਪੂਰੇ ਪਰਿਵਾਰ ਨੂੰ ਪੂਰਾ ਦਿਨ ਬਹੁਤ ਖੇਚਲ ਹੋਈ ਅਤੇ ਜਿਸ ਕਾਰਨ ਸਾਡੇ ਪਰਿਵਾਰ ਵਿੱਚ ਲੜਾਈ ਵਾਲਾ ਮਾਹੌਲ ਵੀ ਬਣ ਗਿਆ ਕਿ ਸਾਡੇ ਪਰਿਵਾਰ ਵਾਲੇ ਖਿਝਣ ਲੱਗ ਪਏ ਕਿ ਕੈਬ ਹਜੇ ਤੱਕ ਨਹੀ ਆਈ ਅਤੇ ਜਿਸ ਕਰਕੇ ਮੈਂ ਤੁਹਾਨੂੰ ਇਹ ਰਿਪੋਰਟ ਦੇਣਾ ਚਾਹੁੰਦਾ ਕਿ ਜਿਹੜੀ ਕੈਬ ਮੈਂ ਸਵੇਰੇ ਬੁੱਕ ਕੀਤੀ ਸੀ ਉਹ ਹੁਣ ਰੱਦ ਕਰ ਦਿੱਤੀ ਜਾਵੇ ਅਤੇ ਜਿਹੜੇ ਪੈਸੇ ਮੈਂ ਤੁਹਾਨੂੰ ਟ੍ਰਾਂਸਫਰ ਕੀਤੇ ਸੀ ਕਿਰਪਾ ਕਰਕੇ ਮੇਰੇ ਪੈਸੇ ਮੈਨੂੰ ਰੀਫੰਡ ਕਰ ਦਿੱਤੇ ਜਾਣ ਤਾਂ ਕਿ ਜੋ ਮੇਰੀ ਯਾਤਰਾ ਕੈ ਅੱਜ ਦੀ ਰੱਦ ਹੋਈ ਹੈ ਉਹ ਮੈਂ ਕਿਸੇ ਹੋਰ ਦਿਨ ਆਪਣੀ ਯਾਤਰਾ ਉਹ ਜੋ ਪੂਰੀ ਕਰ ਸਕਾਂ